ਹੈਲੋ ਤੁਸੀਂ ਡੋਮੀਨੋਜ਼ ਤੋਂ ਬੋਲ ਰਹੇ ਹੋ ਸਰ ਜੀ ਮੈਂ ਥੋੜ੍ਹੀ ਦੇਰ ਪਹਿਲਾਂ ਤੁਹਾਡੇ ਕੋਲ ਇੱਕ ਔਡਰ ਕੀਤਾ ਸੀ ਠੀਕ ਆ ਜੀ ਅਤੇ ਉਹ ਔਡਰ ਤੁਸੀਂ ਮੇਰੇ ਪਤੇ 'ਤੇ ਗ਼ਲਤ ਡਿਲੀਵਰ ਕੀਤਾ ਹੈ ਤੁਹਾਨੂੰ ਮੈਂ ਪੁੱਛਿਆ ਸੀ ਕਿ ਤੁਹਾਡੇ ਕੋਲ ਇਹ ਵਾਲਾ ਪੀਜ਼ਾ ਅਵੇਲੇਬਲ ਹੈ ਤੁਸੀਂ ਕਿਹਾ ਹਾਂਜੀ ਅੱਧੇ ਘੰਟੇ ਤੱਕ ਤੁਹਾਡੇ ਘਰ ਤੱਕ ਇਹ ਪਹੁੰਚ ਜਾਵੇਗਾ ਅਤੇ ਸਰ ਅੱਧੇ ਘੰਟੇ 'ਚ ਤੁਸੀਂ ਪਹੁੰਚਾ ਤਾਂ ਦਿੱਤਾ ਲੇਕਿਨ ਉਹ ਵੀ ਜੋ ਔਡਰ ਕੀਤਾ ਸੀ ਉਹ ਤੁਸੀਂ ਸਾਰਾ ਉ ਉਲਟ ਭੇਜਿਆ ਤੁਹਾਨੂੰ ਕਿਹਾ ਗਿਆ ਸੀ ਕਿ ਉਹਦੇ ਵਿੱਚ ਮਸ਼ਰੂਮਸ ਨਹੀਂ ਹੋਣੀਆਂ ਚਾਹੀਦੀਆਂ ਅਤੇ ਤੁਸੀਂ ਸਪੈਸ਼ਲ ਹੀ ਮਾਸ਼ਰੂਮ ਦੇ ਨਾਲ਼ ਸਜਾ ਕੇ ਉਹਨੂੰ ਮੇਰੇ ਘਰ ਭੇਜਿਆ ਤੁਹਾਨੂੰ ਪਤਾ ਹੈ ਮੇਰੇ ਘਰ ਜਿਹੜੇ ਮਹਿਮਾਨ ਆਏ ਹੋਏ ਹਨ ਉਹਨਾਂ ਵਿੱਚੋਂ ਦੋ ਜਣਿਆਂ ਨੂੰ ਮਸ਼ਰੂਮ ਦੇ ਨਾਲ਼ ਐਲਰਜੀ ਹੈ ਹੁਣ ਦੱਸੋ ਉਹਦਾ ਤੁਸੀਂ ਕੀ ਜਵਾਬ ਦਿਉਗੇ ਕੀ ਤੁਸੀਂ ਰਿਸਪੋਂਸੀਬਲ ਹੋ ਉਸ ਚੀਜ਼ ਦੇ ਲਈ ਐਨਾ ਵੱਡਾ ਰੈਸਟੋਰੈਂਟ ਅਤੇ ਐਡੀ ਵੱਡੀ ਗ਼ਲਤੀ ਇਹ ਕਿਸ ਤਰ੍ਹਾਂ ਕਰ ਸਕਦੇ ਹੋ ਸਰ ਤੁਸੀਂ ਨਾ ਹੁਣ ਮੈਂ ਤੁਹਾਡੀ ਕੀ ਗੱਲ ਸੁਣਾ ਕਿਉਂ ਸੁਣਾ ਤੁਸੀਂ ਅੱਧੇ ਘੰਟੇ ਦੀ ਵਾਲੀ ਗੱਲ 'ਤੇ ਆਪਣੀ ਪੂਰੀ ਕਾਇਮ ਰਹਿੰਦੇ ਹੋ ਲੇਕਿਨ ਜਿਹੜੀ ਤੁਹਾਡੀ ਉੱਥੇ ਹੋਣੀ ਚਾਹੀਦੀ ਗੁਣਵੱਤਾ ਉਹਦਾ ਕੀ ਤੁਹਾਨੂੰ ਐਨਾ ਵੱਡਾ ਨਾਮ ਦੇਖ ਕੇ ਔਡਰ ਕੀਤਾ ਗਿਆ ਜਿੰਨੇ ਪੈਸੇ ਤੁਸੀਂ ਕਹੇ ਅਸੀਂ ਉਹਦੇ ਨਾਲ਼ ਹੀ ਤੁਹਾਨੂੰ ਕਿਹਾ ਹਾਂਜੀ ਠੀਕ ਹੈ ਜੀ ਅਸੀਂ ਤੁਹਾਨੂੰ ਪੈਸੇ ਵੀ ਔਨਲਾਈਨ ਟਰਾਂਸਫਰ ਕਰ ਦਿੱਤੇ ਫਿਰ ਹੁਣ ਉਹ ਕੀ ਹੋ ਗਿਆ ਨਾ ਉਹ ਚੀਜ਼ ਮੇਰੇ ਕੰਮ ਦੀ ਪੈਸੇ ਤੁਸੀਂ ਰੱਖ ਲਏ ਦੱਸੋ ਕੀ ਕਰੀਏ